ਭੰਗੜਾ ਐਰੋਬਿਕਸ ਰਵਾਇਤੀ ਭੰਗੜਾ ਨਾਚ ਦੀ ਊਰਜਾਵਾਨ ਜਸ਼ਨ ਭਾਵਨਾ ਨੂੰ ਸੰ ਮੂਰਤੀਵਾਨ ਕਰਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਜੋ ਕਿ ਪੰਜਾਬੀ ਕਿਸਾਨਾਂ ਦੁਆਰਾ ਆਪਣੀ ਵਾਢੀ ਦਾ ਜਸ਼ਨ ਮਨਾਉਂਦੇ ਹੋਏ ਜ਼ੋਰਦਾਰ ਹਰਕਤਾਂ ਜੀਵਨ ਅਤੇ ਪਹਿਰਾਵੇ ਅਤੇ ਜੀਵਨ ਅਤੇ ਸੰਗੀਤ ਦੁਆਰਾ ਆਪਣੀ ਤਾਕਤ ਅਤੇ ਆਨੰਦ ਨੂੰ ਪ੍ਰਦਾ ਪ੍ਰਦਰਸ਼ਨ ਕਰਦੇ ਹੋਏ ਖੇਤੀ ਖੇਤਰ ਨਾਲ ਜੁੜੇ ਸਖਤ ਮਿਹਨਤ ਅਤੇ ਲਚਕੀਲੇਪਣ ਨੂੰ ਦਰਸਾਉਂਦੇ ਹੋਏ ਸਰੀਰਿਕ ਗਤੀਵਿਧੀ ਦੁਆਰਾ ਪੰਜਾਬੀ ਸੱਭਿਆਚਾਰ ਦੇ ਤੱਤ ਨੂੰ ਲਾਜ਼ਮੀ ਤੌਰ 'ਤੇ ਹਾਸਿਲ ਕਰਨਾ ਭੰਗੜੇ ਬਾਰੇ ਮੁੱਖ ਨੁਕਤੇ ਅਤੇ ਇਸ ਸੱਭਿਆਚਾਰ ਮਹੱਤਤਾ ਖੇਤੀ ਵਿੱਚ ਮੁੱਲ ਭੰਗੜਾ ਰਿਵਾਇਤੀ ਤੌਰ 'ਤੇ ਕਿਸਾਨਾਂ ਦੁਆਰਾ ਵਾਢੀ ਦੇ ਬਾਅਦ ਪੇਸ਼ ਕੀਤਾ ਜਾਂਦਾ ਹੈ ਜੋ ਕਿ ਸਰੀਰਿਕ ਤੌਰ 'ਤੇ ਮੰਗ ਵਾਲੀ ਜੀਵਨ ਸ਼ੈਲੀ ਵਿੱਚ ਉਹਨਾਂ ਦੀ ਪ੍ਰਾਪਤੀ ਅਤੇ ਖੁਸ਼ੀ ਨੂੰ ਦਰਸਾਉਂਦੇ ਹਨ ਉਰਜਾਵਾਨ ਅੰਦੋਲਨ ਡਾਂਸ ਸ਼ੈਲੀ ਤੇਜ਼ ਸ਼ਕਤੀਸ਼ਾਲੀ ਅਤੇ ਗਤੀਸ਼ੀਲ ਹਰਕਤਾਂ ਦੁਆਰਾ ਵਿਸ਼ੇਸ਼ਿਤ ਹੈ ਜੋ ਪੰਜਾਬੀ ਲੋਕ ਦੀ ਊਰਜਾ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ ਰੰਗੀਨ ਪਹਿਰਾਵਾ ਭੰਗੜੇ ਦੇ ਪਹਿਰਾਵੇ ਜੋਸ਼ੀਲੇ ਹੁੰਦੇ ਹਨ ਅਤੇ ਅਕਸਰ ਗੁੰਝਲਦਾਰ ਕਢਾਈ ਸ਼ਾਮਿਲ ਕਰਦੇ ਹਨ ਜੋ ਪੰਜਾਬ ਦੇ ਅਮੀਰ ਸੱਭਿਆਚਾਰ ਸੂਹਜ ਨੂੰ ਦਰਸਾਉਂਦੇ ਹਨ ਕਮਿਊਨਿਟੀ ਜਸ਼ਨ ਭੰਗੜਾ ਵਿਆਹਾਂ ਤਿਓਹਾਰਾਂ ਅਤੇ ਹੋਰ ਜਸ਼ਨ ਦੇ ਮੌਕਿਆਂ 'ਤੇ ਪੇਸ਼ ਕੀਤਾ ਜਾਂਦਾ ਹੈ ਲੋਕਾਂ ਨੂੰ ਇਕੱਠੇ ਲਿਆਉਂਦੇ ਹਨ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੇ ਹਨ ਮਰਦਾਨਾ ਮੁੱਲ ਰਿਵਾਇਤੀ ਤੌਰ 'ਤੇ ਭੰਗੜਾ ਮੁੱਖ ਤੌਰ 'ਤੇ ਮਰਦਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਜੋ ਤਾਕਤ ਸਖਤ ਸ ਮਿਹਨਤ ਅਤੇ ਲਚਕੀਲੇਪਣ ਵਰਗੇ ਮੁੱਲ ਨੂੰ ਦਰਸਾਉਂਦਾ ਹੈ